ਖੇਤੀਬਾੜੀ ਦੇ ਨਾਲ ਨਾਲ ਹੋਰ ਵੀ ਬਹੁਤ ਸਹਾਇਕ ਧੰਦੇ ਨੇ ਜੋ ਕਿਸਾਨ ਕਰ ਵੀ ਰਹੇ ਨੇ ਤੇ ਕਰਨਾ ਵੀ ਪਸੰਦ ਕਰਦੇ ਨੇ ਅੱਜ ਕੱਲ ਸਿਰਫ ਖੇਤੀਬਾੜੀ ਦੇ ਨਾਲ ਉਨ੍ਹਾਂ ਗੁਜ਼ਾਰਾ ਨਹੀਂ ਹੋ ਰਿਹਾ ਕਿਉਂਕਿ ਕੁਦਰਤੀ ਮਾਰ ਪੈ ਜਾਂਦੀ ਆ ਕਦੀ ਕੀੜਿਆਂ ਦੀ ਫਸਲੀ ਮਾਰ ਪੈ ਗਈ ਕਦੇ ਗੜੇ ਮਾਰੀ ਹੋ ਗਈ ਪਰ ਸੋ ਉਸ ਕਰਕੇ ਨੁਕਸਾਨ ਬਹੁਤ ਹੁੰਦਾ ਇਸ ਕਰਕੇ ਕਿਸਾਨ ਹੋਰ ਧੰਦੇ ਨੇ ਜੋ ਸਹਾਇਕ ਧੰਦੇ ਨੇ ਉਹ ਨਾਲ ਨਾਲ ਕਰਨਾ ਪਸੰਦ ਕਰਦੇ ਨੇ ਜਿਵੇਂ ਕਿ ਮੱਖੀ ਪਾਲਣਾ ਡੇਅਰੀ ਫਾਰਮ ਦਾ ਧੰਦਾ ਹੋ ਗਿਆ ਹੋਰ ਜਿੱਦਾਂ ਜੈਵਿਕ ਖਾਦਾ ਬਣਾਉਣੀ ਗੰਡੋਇਆਂ ਦੀ ਖਾਦ ਬਣਾਉਣੀ ਜਿਹਨੂੰ ਬਰਮੀ ਕੰਪੋਸਟਿੰਗ ਕਹਿੰਦੇ ਆ ਆਪਾਂ ਠੀਕ ਹੈ ਜੀ ਇਹ ਅਜਿਹੇ ਸਹਾਇਕ ਧੰਦੇ ਨੇ ਜੋ ਖੇਤੀ ਦੇ ਨਾਲ ਨਾਲ ਸਾਨੂੰ ਚੌਖੀ ਇਨਕਮ ਚੌਖੀ ਕਮਾਈ ਦਿੰਦੇ ਨੇ ਹੋਰ ਧੰਦੇ ਜਿਵੇਂ ਕਿ ਜਿਆਦਾਤਰ ਲੋਕ ਅੱਜ ਕੱਲ ਬੱਕਰੀ ਪਾਲਣ ਕਰ ਰਹੇ ਨੇ ਜਾਂ ਸੂਰ ਪਾਲਣ ਸੂਰ ਪਾਲਣ ਦਾ ਧੰਦਾ ਕਰ ਰਹੇ ਨੇ ਇਹਨਾਂ ਦੇ ਉੱਪਰ ਜਿਆਦਾ ਮਿਹਨਤ ਨਹੀਂ ਲੱਗਦੀ ਮਧੂ ਮੱਖੀ ਪਾਲਣਾ ਜੋ ਸਰਦੀਆਂ ਦੇ ਵਿੱਚ ਆਪਾਂ ਦੇਖੀਏ ਤਾਂ ਜਿੱਦਾਂ ਸਰੋਆਂ ਦੇ ਫੁੱਲ ਪੈਂਦੇ ਨੇ ਸਫੈਦਿਆਂ ਨੂੰ ਫੁੱਲ ਪੈਂਦੇ ਨੇ ਜਾਂ ਬਸੰਤ ਰੁੱਤ ਦੇ ਵਿੱਚ ਆਪਾਂ ਦੇਖਦੇ ਆ ਹਰ ਇੱਕ ਦਰੱਖਤ ਨੂੰ ਹਰ ਇੱਕ ਪੌਦੇ ਨੂੰ ਫੁੱਲ ਪੈਂਦੇ ਨੇ ਤਾਂ ਉਹਨਾਂ ਟਾਇਮਾਂ ਦੇ ਵਿੱਚ ਜੋ ਮਧੂ ਮੱਖੀਆਂ ਨੇ ਤੇ ਉਹ ਬਹੁਤ ਵਧੀਆ ਤੇ ਚੰਗਾ ਸ਼ਾਇਦ ਬਣਾਉਂਦੀਆਂ ਨੇ ਚੰਗੀ ਕਮਾਈ ਕੀਤੀ ਜਾ ਸਕਦੀ ਆ ਬੱਕਰੀ ਪਾਲਣ ਦਾ ਧੰਦਾ ਕੋਈ ਜਿਆਦਾ ਮਿਹਨਤ ਵਾਲਾ ਕੰਮ ਨਹੀਂ ਹੈਗਾ ਤੇ ਕਮਾਈ ਚੌਖੀ ਦੇ ਕੇ ਜਾਂਦਾ ਸਾਨੂੰ ਹੋਰ ਜਿਵੇਂ ਐਦਾਂ ਕਿ ਡੇਅਰੀ ਫਾਰਮ ਦਾ ਦੀ ਗੱਲ ਕਰ ਲਈਏ ਆਪਾਂ ਉਹਦੇ ਵਿੱਚ ਦੁੱਧ ਵੇਚਣ ਦੇ ਨਾਲ ਨਾਲ ਹੋਰ ਵਸਤਾਂ ਬਣਾ ਕੇ ਜਿੱਦਾਂ ਕਿ ਖੋਆ ਦਹੀਂ ਘਿਓ ਪਨੀਰ ਬਣਾ ਕੇ ਵੀ ਵੇਚਿਆ ਜਾ ਸਕਦਾ ਤੋ ਜਿਸ ਤੋਂ ਅਸੀਂ ਚੰਗੀ ਕਮਾਈ ਕਰ ਸਕਦੇ ਹਾਂ ਸੋ ਸਾਰੇ ਕਿਸਾਨ ਅੱਜ ਕੱਲ ਜਿਆਦਾਤਰ ਪੰਜਾਬ ਦੇ ਵਿੱਚ ਕੋਈ ਵੀ ਕੋਈ ਕਿਸਾਨ ਅਜਿਹਾ ਹੋਵੇਗਾ ਜੋ ਖੇਤੀ ਦੇ ਨਾਲ ਕੋਈ ਹੋਰ ਸਹਾਇਕ ਧੰਦਾ ਨਹੀਂ ਕਰ ਰਿਹਾ